ਮੈਨੂੰ ਤੈਰਾਕੀ ਕਰਨਾ ਬਹੁਤ ਪਸੰਦ ਹੈ ਇਹ ਇੱਕ ਤਰ੍ਹਾਂ ਦੀ ਮੇਰੀ ਹੌਬੀ ਆ ਮੇਰੀ ਮਨਪਸੰਦ ਖੇਡ ਹੈ ਮੈਨੂੰ ਅੰਡਰ ਵੋਟ ਅੰਡਰ ਵਾਟਰ ਜਾਂ ਲੌਂਗ ਵਾਟਰ ਵਾਟਰ ਤੈਰਾਕੀ ਕਰਨਾ ਬਹੁਤ ਪਸੰਦ ਹੈ ਮੈਂ ਬਹੁਤ ਸਾਰੇ ਮੁਕਾਬਲਿਆਂ ਮੁਕਾਬਲੇ ਖੇਡੇ ਅਤੇ ਜਿੱਤੇ ਹਨ ਜਿਵੇਂ ਕਿ ਅਸੀਂ ਸਟੇਟ ਲੈਵਲ ਦੇ ਇੱਕ ਮੁਕਾ ਸਾਡਾ ਸਟੇਟ ਲੈਵਲ ਦਾ ਇੱਕ ਮੁਕਾਬਲਾ ਹੋਇਆ ਸੀ ਅਤੇ ਅਸੀਂ ਅਤੇ ਉਸ ਵਿੱਚ ਉਸ ਵਿੱਚ ਬਹੁਤ ਸਾਰੇ ਬਹੁਤ ਸਾਰੇ ਨੌਜਵਾਨਾਂ ਨੇ ਭਾਗ ਲਿੱਤਾ ਸੀ ਅਤੇ ਉਹ ਮੁਕਾਬਲਾ ਬਹੁਤ ਵਧੀਆ ਹੋਇਆ ਸੀ ਅਤੇ ਮੈਂ ਸੈਕਿੰਡ ਨੰਬਰ ਉੱਤੇ ਆਈ ਸੀ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਸੀ ਅਤੇ ਉਨਾਂ ਨੇ ਟਰੋਫੀ ਦੇ ਨਾਲ਼ ਨਾਲ਼ ਪੈਸਿਆਂ ਨਾਲ਼ ਵੀ ਸਨਮਾਨਿਤ ਕੀਤਾ ਸੀ ਇਸ ਨਾਲ਼ ਮੇਰਾ ਹੌਂਸਲਾ ਬਹੁਤ ਹੀ ਵੱਧ ਗਿਆ ਫਿਰ ਅਸੀਂ ਮਨੋਰੰਜਨ ਦੇ ਲਈ ਇੱਕ ਵਾਰ ਅਸੀਂ ਮਨੋਰੰਜਨ ਦੇ ਲਈ ਆਪਣੇ ਦੋਸਤਾਂ ਨਾਲ਼ ਆਪਣੇ ਦੋਸਤਾਂ ਨਾਲ਼ ਤੈਰਾਕੀ ਦੌੜ ਵਿੱਚ ਗਏ ਉਹ ਖੰਨੇ ਸ਼ਹਿਰ ਦੇ ਕੋਲ ਇੱਕ ਵਾਟਰ ਪਾਰਕ ਸੀ ਉਹ ਬਹੁਤ ਵਧੀਆ ਵਾਟਰ ਪਾਰਕ ਸੀ ਉੱਥੇ ਮੈਂ ਆਪਣੇ ਮੇਰੇ ਅਤੇ ਮੇਰੇ ਦੋਸਤਾਂ ਨੇ ਤੈਰਾਕੀ ਦੇ ਅਲੱਗ ਅਲੱਗ ਸਟੈੱਪ ਕੀਤੇ ਅਤੇ ਉੱਥੇ ਬਹੁਤ ਵਧੀਆ ਮਨੋਰੰਜਨ ਅਤੇ ਮਾਹੌਲ ਸੀ ਏ ਮੈਂ ਆਪਣੇ ਦੋਸਤਾਂ ਨਾਲ਼ ਬਹੁਤ ਇੰਜੋਏ ਕੀਤਾ ਅਤੇ ਅਨੁਭਵ ਬਹੁਤ ਮਾਣਿਆ